ਭਾਰਤ ਸ਼ੁਰੂ ਤੋਂ ਹੀ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਰਿਹਾ ਹੈ ਈਸਟ ਇੰਡੀਆ ਕੰਪਨੀ ਜੋ ਕਿ ਵਪਾਰ ਕਰਨ ਵਾਸਤੇ ਆਈ ਸੀ ਇੱਥੇ ਦੋ ਸੌ ਸਾਲ ਰਾਜ ਕਰਕੇ ਗਈ ਅੱਜ ਦੀ ਮਿਤੀ ਵਿੱਚ ਜਦੋਂ ਕੋਈ ਸੈਲਾਨੀ ਬਾਹਰੋਂ ਆਉਂਦਾ ਹੈ ਤਾਂ ਸਭ ਤੋਂ ਮਸ਼ਹੂਰ ਜਿਹੜੀ ਜਗ੍ਹਾ ਹੈ ਜੋ ਕਿ ਸੱਤ ਅਜੂਬਿਆਂ ਵਿੱਚੋਂ ਇੱਕ ਹੈ ਤਾਜ ਮਹਿਲ ਆਗਰਾ ਵਿੱਚ ਸਥਿਤ ਹੈ ਇਸ ਨੂੰ ਸ਼ਾਹ ਜਹਾਨ ਨੇ ਮੁਮਤਾਜ਼ ਮਹਿਲ ਦੀ ਯਾਦ ਵਿੱਚ ਚਿੱਟੇ ਸੰਗਮਰਮਰ ਤੋਂ ਬਣਾਇਆ ਸੀ ਜੋ ਕਿ ਅੱਜ ਵੀ ਬਹੁਤ ਹੀ ਆਕਰਸ਼ਣ ਦਾ ਕੇਂਦਰ ਹੈ ਦਿੱਲੀ ਦੇ ਵਿੱਚ ਇੰਡੀਆ ਗੇਟ ਲਾਲ ਕਿਲ੍ਹਾ ਕੁਤੁਬ ਮੀਨਾਰ ਇਸ ਨੂੰ ਵੇਖਣ ਲਈ ਦੁਨੀਆਂ ਤੋਂ ਲੋਕ ਆਉਂਦੇ ਹਨ ਮੁੰਬਈ ਦੇ ਵਿੱਚ ਗੇਟਵੇ ਔਫ ਇੰਡੀਆ ਅਜੰਤਾ ਅਲੋਰਾ ਦੀਆਂ ਕੇਵਜ ਇਹ ਵੀ ਆਕਰਸ਼ਣ ਦਾ ਕੇਂਦਰ ਹਨ ਜੇ ਤੁਸੀਂ ਰਾਜਸਥਾਨ ਦੇ ਵਿੱਚ ਵੇਖੋ ਤਾਂ ਅੰਬਰ ਫੋਟ ਜੈਪੁਰ ਦਾ ਹਵਾ ਮਹਿਲ ਜੈਪੁਰ ਦਾ ਇਹ ਬਹੁਤ ਲੋਕਾਂ ਨੂੰ ਅਟਰੈਕਟ ਕਰਦਾ ਹੈ ਇਸ ਤੋਂ ਇਲਾਵਾ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤਾਂ ਸਿੱਖਾਂ ਦਾ ਪੂਜਨੀਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਫਿਰ ਜਲ੍ਹਿਆਂਵਾਲਾ ਬਾਗ ਇਹ ਇੱਥੇ ਸਥਿਤ ਹਨ ਜੇ ਕੋਈ ਸ਼ੋਪਿੰਗ ਦਾ ਸ਼ੌਕੀਨ ਹੈ ਤਾਂ ਲੁਧਿਆਣਾ ਜਿਸ ਨੂੰ ਕਿ ਮਾਨਚੈਸਟਰ ਔਫ ਇੰਡੀਆ ਵੀ ਕਿਹਾ ਜਾਂਦਾ ਹੈ ਉਹ ਵੀ ਹੌਜ਼ਰੀ ਇੰਡਸਟਰੀ ਕਰਕੇ ਬਹੁਤ ਮਸ਼ਹੂਰ ਹੈ ਇਹ ਕੁਝ ਆਕਰਸ਼ਣ ਕੇਂਦਰ ਹਨ ਜੋ ਭਾਰਤ ਵਿੱਚ ਬਹੁਤ ਹੀ ਮਹੱਤਵਪੂਰਨ ਹਨ